ਖੇਡ ਨਾਲ ਬਹੁਤ ਜ਼ਿਆਦਾ ਗੁਣ ਸਾਡੇ ਵਿੱਚ ਪ੍ਰਭਾਵਿਤ ਹੁੰਦੇ ਹਨ ਜਿਵੇਂ ਕਿ ਲੀਡਰਸ਼ਿਪ ਅਤੇ ਲੀਡਰਸ਼ਿਪ ਦੀ ਕੁਆਲਿਟੀ ਦਾ ਪਤਾ ਲੱਗਦਾ ਹੈ ਅਤੇ ਸਾਨੂੰ ਇੱਕ ਇੱਕਮੁੱਠ ਹੋ ਕੇ ਰਹਿਣ ਦਾ ਪਤਾ ਲੱਗਦਾ ਹੈ ਅਤੇ ਇੱਦਾਂ ਹੀ ਬਹੁਤ ਸਾਰੇ ਪੋਜ਼ੀਟਿਵ ਪ੍ਰਭਾਵ ਮਿਲਦੇ ਹਨ ਜਿਵੇਂ ਕਿ ਅਸੀਂ ਸਿਹਤ ਦੇ ਪੱਖੋਂ ਬਹੁਤ ਜ਼ਿਆਦਾ ਫਿੱਟ ਹੋ ਜਾਂਦੇ ਹਨ ਅਤੇ ਇੱਦਾਂ ਹੀ ਹੋਰ ਜ਼ਿਆਦਾ ਸਾਡੇ ਜਦੋਂ ਫੇਮ ਮਿਲ ਜਾਂਦਾ ਹੈ ਤਾਂ ਉਸ ਨਾਲ ਸਾਡੇ ਮਾਤਾ ਪਿਤਾ ਦਾ ਨਾਂ ਰੋਸ਼ਨ ਅਤੇ ਸਾਡੇ ਪਿੰਡ ਦਾ ਅਤੇ ਸਾਡੇ ਇਲਾਕੇ ਦਾ ਨਾਮ ਰੋਸ਼ਨ ਹੋ ਜਾਂਦਾ ਹੈ